ਸਮੇਂ ਦੇ ਨਾਲ ਪੰਜਾਬ ਦਾ ਸੱਭਿਆਚਾਰ 'ਚ ਬਹੁਤ ਬਦਲਾਵ ਆਇਆ ਹੈ ਜੋ ਪੁਰਾਣੇ ਵਕਤ ਦੇ ਵਿੱਚ ਜੋ ਸੱਭਿਆਚਾਰਕ ਸਾਂਝ ਸੀ ਲੋਕਾਂ ਦੇ ਵਿੱਚ ਉਹ ਤਾਂ ਹੁਣ ਬਿਲਕੁਲ ਹੀ ਖਤਮ ਹੁੰਦੀ ਜਾ ਰਹੀ ਹੈ ਪੰਜਾਬ ਦੇ ਲੋਕ ਹਰ ਕੰਮ ਵਿੱਚ ਆਪਣੇ ਨੇੜੇ ਤੇੜੇ ਦੇ ਜਿੰਨੇ ਸਾਕ ਸੰਬੰਧੀ ਆ ਨਾਲ ਗੁਆਂਢ ਆਂਢ ਗੁਆਂਢ ਦਾ ਵਿਚਾਰ ਵਟਾਂਦਰਾ ਕਰਕੇ ਫਿਰ ਹੀ ਕੋਈ ਕੰਮ ਆਰੰਭਿਆ ਕਰਦੇ ਤੇ ਉਸਨੂੰ ਪੂਰਾ ਕਰਦੇ ਸਨ ਪਰ ਅੱਜ ਕੱਲ ਦਾ ਇਹ ਚੀਜ਼ਾਂ ਖਤਮ ਹੀ ਹੁੰਦੀਆਂ ਜਾ ਰਹੀਆਂ ਹਨ ਲੋਕ ਆਪ ਮੁਹਾਰੇ ਹੋ ਗਏ ਹਨ ਆਪਦਾ ਕੰਮ ਆਪ ਹੀ ਕਰਨ ਕਰਕੇ ਬਿੜ ਲੈਂਦੇ ਹਨ ਨਾ ਕਿਸੇ ਨਾਲ ਵਿਚਾਰ ਕਰਦੇ ਹਨ ਚਾਹੇ ਉਹਦੇ ਵਿੱਚ ਉਹਨਾਂ ਨੂੰ ਕਿੰਨੀਆਂ ਵੀ ਮੁਸ਼ਕਲਾਂ ਆਉਣ ਜਾਂ ਅੱਜ ਕੱਲ੍ਹ ਦਾ ਯੁੱਗ ਹੀ ਸਾਰਾ ਪੈਸੇ 'ਤੇ ਨਿਰਭਰ ਹੋ ਗਿਆ ਲੋਕ ਬਸ ਪੈਸੇ ਨੂੰ ਹੀ ਸਭ ਕੁਝ ਸਮਝ ਰਹੇ ਹਨ ਜਿਸ ਦੇ ਕਾਰਨ ਸੱਭਿਆਚਾਰਕ ਸਾਂਝਾਂ ਤਾਂ ਬਿਲਕੁਲ ਹੀ ਖਤਮ ਹੋ ਰਹੀਆਂ ਹਨ